ਸਰ ਮੈਂ ਤੁਹਾਡੀ ਐਪ ਫਰਨੀਚਰ ਡੋਟ ਕੋਮ ਤੋਂ ਇੱਕ ਡਾਇਨਿੰਗ ਟੇਬਲ ਦਾ ਔਡਰ ਦਿੱਤਾ ਸੀ ਇਹ ਔਡਰ ਮੈਨੂੰ ਕੱਲ੍ਹ ਜਿੱਦਾਂ ਪ੍ਰਾਪਤ ਹੋ ਗਿਆ ਹੈ ਸਰ ਲੇਕਿਨ ਬੜੇ ਅਫਸੋਸ ਨਾਲ ਮੈਨੂੰ ਇੱਥੇ ਕਹਿਣਾ ਪੈ ਰਿਹਾ ਕਿ ਇਹ ਔਡਰ ਜੋ ਮੈਨੂੰ ਪ੍ਰਾਪਤ ਹੋਇਆ ਹੈ ਡਾਇਨਿੰਗ ਟੇਬਲ ਅਤੇ ਨਾਲ ਜੋ ਛੇ ਕੁਰਸੀਆਂ ਪ੍ਰਾਪਤ ਹੋਈਆਂ ਹਨ ਉਹਨਾਂ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਪੈਕ ਹੋ ਕੇ ਆਇਆ ਹੈ ਜਾਂ ਤਾਂ ਉੱਥੇ ਰਸਤੇ ਵਿੱਚ ਟਰਾਂਸਪੋਰਟ ਕਰਦੇ ਸਮੇਂ ਇਹਦੇ ਵਿੱਚ ਸਕਰੈਚ ਪੈ ਗਏ ਹਨ ਅਤੇ ਪਾਲਸ਼ ਵੀ ਜਿਹੜੀ ਇਹਨੂੰ ਹੋਈ ਹੈ ਡਾਇਨਿੰਗ ਟੇਬਲ ਨੂੰ ਅਤੇ ਕੁਰਸੀਆਂ ਦੀਆਂ ਬਾਹਾਂ 'ਤੇ ਉਹ ਵੀ ਕੋਈ ਬਹੁਤੀ ਵਧੀਆ ਨਹੀਂ ਹੈ ਇਸ ਤੋਂ ਇਲਾਵਾ ਇਹ ਪਾਲਸ਼ ਦਾ ਰੰਗ ਵੀ ਕੋਈ ਖ਼ਾਸ ਮੈਨੂੰ ਆਕਰਸ਼ਣ ਆਕਰਸ਼ਿਤ ਨਹੀਂ ਕਰ ਰਿਹਾ ਕਿਉਂਕਿ ਜੋ ਤੁਸੀਂ ਔਨਲਾਈਨ ਫੋਟੋ ਵਿੱਚ ਦਿਖਾ ਰਹੇ ਸੀ ਇਹ ਉਹਤੋਂ ਕਿਤੇ ਅਲੱਗ ਹੈ ਜਿਹੜਾ ਲੈਦਰ ਦਾ ਕੱਪੜਾ ਲੱਗਿਆ ਹੋਇਆ ਕੁਰਸੀਆਂ ਦੀ ਬੈਕ 'ਤੇ ਉਹ ਵੀ ਬਹੁਤ ਕੋਈ ਵਧੀਆ ਨਹੀਂ ਹੈ ਉਹ ਕੱਪੜਾ ਕੋਈ ਘਟੀਆ ਕੁਆਲਿਟੀ ਦਾ ਹੈ ਇਸ ਤੋਂ ਇਲਾਵਾ ਡਾਇਨਿੰਗ ਟੇਬਲ 'ਤੇ ਰੱਖਿਆ ਗਿਆ ਸ਼ੀਸ਼ਾ ਜਿਹੜਾ ਹੈ ਜੀ ਉਹ ਮਤਲਬ ਸਾਈਡਾਂ ਤੋਂ ਜਦੋਂ ਗੋਲਾਈ ਵਿੱਚੋਂ ਕੱਟਿਆ ਗਿਆ ਤਾਂ ਉਸਨੂੰ ਪੂਰੀ ਤਰ੍ਹਾਂ ਸਹੀ ਤਰ੍ਹਾਂ ਨਹੀਂ ਕੱਟਿਆ ਗਿਆ ਇਹ ਬੱਚੇ ਦੇ ਹੱਥ ਵਿੱਚ ਲੱਗਣ ਦਾ ਡਰ ਹੈ ਜਿਸ ਨਾਲ ਕੋਈ ਮਤਲਬ ਬੱਚੇ ਦੇ ਸ ਸੱਟ ਜਾਂ ਚੋਟ ਲੱਗ ਸਕਦੀ ਹੈ ਇਸ ਤੋਂ ਇਲਾਵਾ ਇਹਦੀ ਸ਼ੀਸ਼ੇ ਦੀ ਮੋਟਾਈ ਵੀ ਠੀਕ ਨਹੀਂ ਹੈ ਮੇਰੇ ਪਰਿਵਾਰਿਕ ਮੈਂਬਰਾਂ ਵੱਲੋਂ ਅਤੇ ਮੇਰੇ ਗੁਆਂਢ ਵੱਲੋਂ ਵੀ ਇਸ ਦੀ ਕੋਈ ਸਲਾਹਨਾ ਨਹੀਂ ਕੀਤੀ ਗਈ ਹੈ ਅਤੇ ਇਸ ਲਈ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਮੈਨੂੰ ਪ੍ਰੋਡਕਟ ਬਦਲ ਕੇ ਦਿੱਤਾ ਜਾਵੇ